ਪਹਿਲਾਂ ਅਸੀਂ ਜਿਸ ਵਿਅਕਤੀ ਨੂੰ ਸੱਪ ਨੇ ਕੱਟਿਆ ਹੈ ਉਸ ਨੂੰ ਰੈਸਟ ਫੀਲ ਕਰਾਵਾਂਗੇ ਉਸ ਅਤੇ ਉਸਨੂੰ ਆਰਾਮ ਨਾਲ ਲਿਟਾ ਦੇਵਾਂਗੇ ਫਿਰ ਜਿੱਥੇ ਸੱਪ ਸੱਪ ਨੇ ਉਸ ਨੂੰ ਕੱਟਿਆ ਹੈ ਉਸ ਥਾਂ ਤੋਂ ਤਿੰਨ ਉਂਗਲ ਉੱਪਰ ਕ ਉੱਪਰ ਉੱਪਰ ਇੱਕ ਪੱਟੀ ਜਾਂ ਕੁਛ ਬੰਨ ਦੇਵਾਂਗੇ ਤਾਂ ਕਿ ਜਿਹੜੀ ਜਿਹੜੀ ਜ਼ਹਿਰ ਆ ਉਹ ਉੱਪਰ ਨਾ ਜਾ ਸਕੇ ਅਤੇ ਉਹ ਸਾਰੇ ਸਰੀਰ ਵਿੱਚ ਫੈਲ ਨਾ ਸਕੇ ਅਤੇ ਫਿਰ ਉੱ ਅਤੇ ਫਿਰ ਅਸੀਂ ਫਿਰ ਉਸਨੂੰ ਪਾਣੀ ਪਿਲਾਵਾਂਗੇ ਅਤੇ ਉਸ ਨੂੰ ਅਤੇ ਉਸ ਨੂੰ ਕਹਾਂਗੇ ਕਿ ਥੋੜ੍ਹੀ ਦੇਰ ਰੈਸਟ ਕਰ ਅਤੇ ਫਿਰ ਉਸ ਨੂੰ ਉਸਨੂੰ ਕਹਾਂਗੇ ਕਿ ਤੂੰ ਠੀਕ ਹੈ ਘਬਰਾ ਨਾ ਉਸਨੂੰ ਘਬਰਾਉਣ ਨਹੀਂ ਦੇਣਾ ਅਤੇ ਉਸਦੇ ਦਿਮਾਗ ਉੱਤੇ ਪਰੇਸ਼ਾਨੀ ਵਾਲੀ ਗੱਲ ਆਉਣ ਨਹੀਂ ਦੇਣੀ ਅਤੇ ਫਿਰ ਅਸੀਂ ਉਸਨੂੰ ਡੋਕਟਰ ਦੇ ਕੋਲ ਲੈ ਕੇ ਜਾਣਾ ਹੈ ਫਿਰ ਡੋਕਟਰ ਆਪਣਾ ਜਿਹੜਾ ਟਰੀਟਮੈਂਟ ਹੈਗਾ ਉਹ ਸ਼ੁਰੂ ਕਰੂਗਾ ਅਤੇ ਜਿਵੇਂ ਕਿ ਟੀਕੇ ਲੱਗਦੇ ਆ ਜਾਂ ਜਾਂ ਕਈ ਜਾਂ ਕਈ ਲੋਕ ਜਾਂ ਪੁਰਾਣੇ ਜ਼ਮਾਨੇ ਵਿੱਚ ਸੱਪ ਦੇ ਕੱਟੇ ਦਾ ਹੱਥੋਲ਼ਾ ਵੀ ਕਰਦੇ ਸਨ ਜ ਜੇ ਜਾਂ ਕਿ ਜਿਹੜੀ ਜ਼ਹਿਰ ਆ ਉਹ ਸਾਰੇ ਸਰੀਰ ਵਿੱਚ ਫੈਲ ਨਾ ਸਕੇ ਕਈ ਲੋਕ ਇਸ ਇਸਦੀ ਮੁੱਢਲੀ ਸਹਾਇਤਾ ਵੀ ਜਾਣਦੇ ਹਨ ਮੁੱਢਲੀ ਸਹਾਇਤਾ ਵੀ ਜਾਣਦੇ ਹਨ ਤਾਂ ਕਿ ਜਿਹੜੇ ਸੱਪ ਦਾ ਉਹ ਜ਼ਹਿਰ ਆ ਉਹ ਸਾਰੇ ਉਹ ਟਾਈਮ ਨਾਲ ਕੱਢਿਆ ਜਾ ਸਕੇ ਅਤੇ ਪੂਰੇ ਪੂਰੇ ਸਰੀਰ ਵਿੱਚ ਨਾ ਫੈਲਿਆ ਜਾ ਸਕੇ ਇਸ ਰਾਹੀਂ ਅਸੀਂ ਇਸ ਦੀ ਇਸ ਮਦਦ ਨਾਲ ਅਸੀਂ ਸੱਪ ਦੀ ਜ਼ਹਿਰ ਨੂੰ ਠੀਕ ਕਰ ਸਕਦੇ ਹਾਂ